ਸਭ ਤੋਂ ਚੁਣੌਤੀਪੂਰਨ ਟਾਈਮ ਉਸ ਦਿਨ ਲੰਘਿਆ ਜਦੋਂ ਮੈਂ ਰਾਤ ਨੂੰ ਆਪਣੇ ਸਾਈਕਲ 'ਤੇ ਜਾ ਰਿਹਾ ਸੀ ਰਸਤੇ ਵਿੱਚ ਕੁਛ ਲੋਕਾਂ ਨੇ ਮੇਰਾ ਪਿੱਛਾ ਕਰਨਾ ਸ਼ੁਰੂ ਕਰਤਾ ਮੈਂ ਆਪਣਾ ਸਾਈਕਲ ਉੱਥੋਂ ਕੱਚੇ 'ਚ ਉਤਾਰ ਕੇ ਮੋਢਿਆਂ 'ਤੇ ਚੱਕ ਕੇ ਪਰਲੇ ਪਾਸੇ ਲੈ ਗਿਆ ਅਤੇ ਬੜੀ ਸਪੀਡ ਨਾਲ ਆਪਣੇ ਜੇਬ 'ਚ ਪ ਪਏ ਹੋਏ ਪੈਸੇ ਬਚਾਉਣ ਵਾਸਤੇ ਅਤੇ ਆਪਣੀ ਜਾਨ ਬਚਾਉਣ ਵਾਸਤੇ ਬਹੁਤ ਹੀ ਤੇਜ਼ੀ ਨਾਲ ਸਾਈਕਲ ਭਜਾ ਕੇ ਸ਼ਹਿਰ ਵੱਲ ਆਇਆ ਅਤੇ ਜਿੱਥੇ ਲੋਕਾਂ ਦਾ ਇਕੱਠ ਸੀਗਾ ਜਿਸ ਨਾਲ ਮੈਂ ਉਹ ਲੋਕਾਂ ਤੋਂ ਬਚ ਪਾਇਆ ਨਹੀਂ ਉਹ ਲੋਕਾਂ ਨੇ ਮੈਨੂੰ ਉਸ ਦਿਨ ਜਾਨ ਤੋਂ ਹੀ ਮਾਰ ਦੇਣਾ ਸੀ ਕਈ ਵਾਰ ਸਾਨੂੰ ਅਣਜਾਣ ਰਸਤੇ 'ਤੇ ਜਾਣ ਲੱਗੇ ਇਹੋ ਜਿਹਾ ਸਥਿਤੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਕਿਉਂਕਿ ਲੋਕ ਜੋ ਵੀ ਹੈ ਅੱਜ ਕੱਲ੍ਹ ਨਸ਼ਿਆਂ ਦਾ ਦੌਰ ਚੱਲ ਰਿਹਾ ਲੋਕ ਰਸਤੇ ਵਿੱਚ ਨਸ਼ੇ ਵਾਸਤੇ ਆਉਂਦੇ ਜਾਂਦੇ ਨੂੰ ਰੋਕ ਕੇ ਪੈਸੇ ਖੋਹਣ ਦੀ ਕੋਸ਼ਿਸ਼ ਕਰਦੇ ਹਨ ਅਤੇ ਆਪਾਂ ਨੂੰ ਉਸ ਤੋਂ ਬਚਣ ਲਈ ਬ ਆਪਣੀ ਜਾਨ ਮੈਂ ਬਹੁਤ ਹੀ ਮੁਸ਼ਕਲ ਨਾਲ ਸਾਇਕਲ ਪੂਰੀ ਸਪੀਡ ਨਾਲ ਭਜਾ ਕੇ ਬਚਿਆ ਹਾਂ